ਭਾਰਤ ਨੂੰ ਰੰਗਾਂ ਅਤੇ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ ਇਸ ਵਿੱਚ ਕਾਫੀ ਤਿਉਹਾਰ ਮਨਾਏ ਜਾਂਦੇ ਹਨ ਇਸਨੂੰ ਗੁਰੂਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਦੀਵਾਲੀ ਅਤੇ ਹੋਲੀ ਅਨਮੋਲ ਹਨ ਦੀਵਾਲੀ ਨੂੰ ਰੋਸ਼ਨੀ ਤਿਉਹਾਰ ਕਿਹਾ ਜਾਂਦਾ ਹੈ ਅਤੇ ਬੁਰਾਈ 'ਤੇ ਚੰਗੇਪਣ ਦੀ ਜਿੱਤ ਦਾ ਪ੍ਰਤੀਕ ਹੈ ਲੋਕ ਆਪਣੇ ਘਰਾਂ ਨੂੰ ਦੀਵੇ ਨਾਲ ਸਜਾਉਂਦੇ ਹਨ ਮਠਿਆਈਆਂ ਵੰਡਦੇ ਹਨ ਅਤੇ ਪਟਾਕੇ ਫੋੜਦੇ ਹਨ ਹੋਲੀ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਇਹ ਪ੍ਰੇਮ ਅਤੇ ਭਾਈਚਾਰੇ ਦਾ ਤਿਉਹਾਰ ਹੈ ਲੋਕ ਇੱਕ ਦੂਜੇ 'ਤੇ ਰੰਗ ਲਗਾਉਂਦੇ ਹਨ ਅਤੇ ਮਠਿਆਈਆਂ ਦਾ ਮਜ਼ਾ ਲੈਂਦੇ ਹਨ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਤਿਉਹਾਰ ਅਤੇ ਛੁੱਟੀਆਂ ਵਿੱਚੋਂ ਦੀਵਾਲੀ ਹੋਲੀ ਈਦ ਕਰਤਾਰਪੁਰ ਸਾਹਿਬ ਦੇ ਗੁਰਪੁਰਬ ਅਤੇ ਰੱਖੜੀ ਹਨ ਇਹਨਾਂ ਤਿਉਹਾਰਾਂ 'ਤੇ ਲੋਕਾਂ ਨੂੰ ਛੁੱਟੀ ਮਿਲਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਾਉਣ ਲਈ ਸਮਾਂ ਬਿਤਾ ਸਕਣ ਦੀਵਾਲੀ ਰੋਸ਼ਨੀ ਦਾ ਤਿਉਹਾਰ ਬੁਰਾਈ 'ਤੇ ਚੰਗੇਪਣ ਦੀ ਜਿੱਤ ਦਾ ਪ੍ਰਤੀਕ ਹੋਲੀ ਰੰਗਾਂ ਦਾ ਤਿਉਹਾਰ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਈਦ ਮੁਸਲਮਨਾਂ ਦਾ ਤਿਉਹਾਰ ਮੁੱਖ ਤਿਉਹਾਰ ਰੋਜੇ ਖਤਮ ਹੋਣ ਦੇ ਮੌਕੇ 'ਤੇ ਮ ਮਨਾਇਆ ਜਾਂਦਾ ਹੈ ਕਰਤਾਰਪੁਰ ਸਾਹਿਬ ਦੇ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਸਿੱਖਾਂ ਲਈ ਮਹੱਤਵਪੂਰਨ ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਇਹ ਤਿਉਹਾਰ ਤਿਉਹਾਰਾਂ ਦੇ ਸਮੁੱਚੇ ਦੇਸ਼ ਵਿੱਚ ਛੁੱਟੀ ਹੁੰਦੀ ਹੈ ਅਤੇ ਜੋ ਹਰ ਕੋਈ ਇਸ ਨੂੰ ਪੂਰੇ ਉਤਸ਼ਾਹ ਨਾਲ ਮਨਾ ਸਕੇ